ਹੈਲੋ ਫਤਿਹ ਸਿੰਘ ਮੈਂ ਤੁਹਾਡੀ ਇੱਕ ਕੈਬ ਬੁੱਕ ਕਰੀ ਸੀ ਆਪਣੀ ਮੀਟਿੰਗ ਵਿੱਚ ਜਾਣ ਵਾਸਤੇ ਅਤੇ ਉਹਦਾ ਟਾਈਮ ਸੀ ਪਹਿਲਾਂ ਬਾਰਾਂ ਵਜੇ ਪਰ ਹੁਣ ਮੈਨੂੰ ਅਰਜੈਂਟਲੀ ਨਾ ਦਸ ਵਜੇ ਨਿਕਲਣਾ ਪੈ ਰਿਹਾ ਹੈ ਕਯਾ ਤੁਸੀਂ ਥੋੜ੍ਹਾ ਜਲਦੀ ਆ ਸਕਦੇ ਹੋ ਧੰਨਵਾਦ